ਭਾਰਤ ਵਿੱਚ ਆਵਾਜਾਈ ਦੀ ਪ੍ਰਣਾਲੀ ਦੀਆਂ ਦਿੱਕਤਾਂ ਹਨ ਜਿਵੇਂ ਕਿ ਬੱਸਾਂ ਘੱਟ ਚਲਦੀਆਂ ਹਨ ਬੱਸ ਸਟੋਪ ਵੀ ਹਰ ਜਗ੍ਹਾ 'ਤੇ ਨਹੀਂ ਹਨ ਜਿਸ ਕਰਕੇ ਕਈ ਵਾਰ ਲੋਕਾਂ ਨੂੰ ਖ਼ਰਾਬ ਮੌਸਮ ਵਿੱਚ ਖੜ੍ਹੇ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਇਸ ਦੇ ਸੁਧਾਰ ਲਈ ਸਰਕਾਰ ਨੂੰ ਜ਼ਿਆਦਾ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਅਤੇ ਸਟੋਪਜ ਵੀ ਬਣਾਉਣੇ ਚਾਹੀਦੇ ਹਨ